ਮੇਰਾ ਆਪਣਾ ਨਿੱਜੀ ਟੀਚਾ ਜਾਂ ਇੱਛਾਵਾਂ ਸਿਰਫ ਇੱਕ ਹੀ ਵੱਲ ਇਸ਼ਾਰਾ ਕਰਦੀਆਂ ਹਨ ਉਹ ਹੈ ਮੇਰਾ ਅਧਿਆਪਨ ਇੱਕ ਅਧਿਆਪਕਾ ਹੋਣ ਦੇ ਨਾਤੇ ਮੇਰਾ ਪਹਿਲਾ ਟੀਚਾ ਅਤੇ ਮੇਰੀ ਇੱਛਾ ਇਹੀ ਹੁੰਦੀਆਂ ਕਿ ਮੇਰੇ ਸਾਰੇ ਪੜ੍ਹਾਏ ਹੋਏ ਵਿਦਿਆਰਥੀ ਚੰਗੀਆਂ ਕਲਾਸਾਂ ਵਿੱਚ ਚੰਗੇ ਨੰਬਰ ਲੈ ਕੇ ਆਪਣੇ ਜੀਵਨ ਦੇ ਵਿੱਚ ਸਫਲ ਹੋਣ ਉਹ ਸਿਰਫ ਇੱਕ ਸਫਲਤਾ ਨੂੰ ਹੀ ਆਪਣਾ ਇੱਕ ਪੈਮਾਨਾ ਨਾ ਬਣਾਉਣ ਉਹ ਇੱਕ ਚੰਗਾ ਇਨਸਾਨ ਬਣਨ ਵੱਲ ਵੀ ਕਦਮ ਚੁੱਕਣ ਮੈਂ ਓਹਨਾ ਨੂੰ ਪੜ੍ਹਾਉਣ ਦੇ ਨਾਲ ਮੇਰਾ ਇੱਕ ਇਹ ਵੀ ਇੱਛਾ ਰਹਿੰਦੀ ਹੈ ਕਿ ਮੇਰੇ ਪੜ੍ਹਾਏ ਹੋਏ ਸਾਰੇ ਵਿਦਿਆਰਥੀ ਹਰ ਇੱਕ ਦੇ ਨਾਲ ਮਿੱਠਾ ਬੋਲਣ ਇੱਕ ਚੰਗਾ ਇਨਸਾਨ ਬਣਨ ਕਿਉਂਕਿ ਇੱਕ ਚੰਗਾ ਇਨਸਾਨ ਹੀ ਸਾਡੇ ਭਾਰਤ ਦਾ ਸਾਡੇ ਪੰਜਾਬ ਦਾ ਇੱਕ ਚੰਗਾ ਵਸਨੀਕ ਅਤੇ ਨਾਗਰਿਕ ਬਣ ਸਕਦਾ ਹੈ ਜਿਹੜਾ ਕਿ ਜਿਹਦੇ ਅੰਦਰ ਮਿਲਵਰਤਨ ਦੀ ਭਾਵਨਾ ਕਿਸੇ ਦੂਸਰੇ ਦੇ ਨਾਲ ਕਿਸੇ ਦੀ ਤਕਲੀਫ ਨੂੰ ਵੇਖ ਕੇ ਉਹਨੂੰ ਦੂਰ ਕਰਨ ਦੀ ਭਾਵਨਾ ਪ੍ਰਬਲ ਹੋਣੀ ਚਾਹੀਦੀ ਹੈ ਇਹ ਸਭ ਕੁਛ ਕਰਨ ਦੇ ਲਈ ਮੈਂ ਸ ਆਪਣੇ ਪੜ੍ਹਾਉਣ ਦੇ ਦੌਰਾਨ ਹੀ ਓਹਨਾਂ ਨੂੰ ਇਹ ਸਾਰੀ ਚੀਜ਼ਾਂ ਦੀ ਮਹੱਤਤਾ ਦੇ ਬਾਰੇ ਦੱਸਦੀ ਹਾਂ ਕਿ ਬੱਚਿਓ ਸਿਰਫ ਅਤੇ ਸਿਰਫ ਅਸੀਂ ਪੜ੍ਹਨਾ ਹੀ ਜ਼ਰੂਰੀ ਨਹੀਂ ਹੈ ਸਾਨੂੰ ਉਸ ਪੜ੍ਹਾਈ ਦਾ ਮਤਲਬ ਪਤਾ ਹੋਣਾ ਚਾਹੀਦਾ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਸਾਨੂੰ ਸਮਾਜਿਕ ਕਿਵੇਂ ਬਣਾਉਂਦਾ ਹੈ ਸਾਡਾ ਚਰਿੱਤਰ ਕਿਵੇਂ ਓਹ ਬਣਾਉਂਦਾ ਹੈ ਇਹ ਮੈਂ ਆਪਣੇ ਅਧਿਆਪਨ ਦੇ ਦੌਰਾਨ ਓਹਨਾਂ ਨੂੰ ਸਿਖਾਉਂਦੀ ਹਾਂ